ਜੋ ਅਸੀਂ ਸਮੱਗਰੀ ਵਿਦੇਸ਼ੀ ਵਰਤੀ ਹੈ ਉਸ ਵਿੱਚ ਜੋ ਅਸੀਂ ਪਾਸਤਾ ਬਣਾਇਆ ਹੈ ਉਹ ਵੀ ਇੱਕ ਵਿਦੇਸ਼ੀ ਚੀਜ਼ ਹੈ ਅਤੇ ਉਸ ਵਿੱਚ ਜੋ ਹੋਰ ਵੀ ਮੇਯੋਨਾਇਜ਼ ਵਗੈਰਾ ਪੈਂਦੀ ਹੈ ਜਾਂ ਮਸਾਲੇ ਪੈਂਦੇ ਹਨ ਉਹ ਵੀ ਸਾਰੇ ਵਿਦੇਸ਼ ਤੋਂ ਤਿਆਰ ਹੁੰਦੇ ਹਨ ਇਨ੍ਹਾਂ ਸਾਰਿਆਂ ਨੂੰ ਅਸੀਂ ਆਪਣੇ ਘਰਾਂ ਵਿੱਚ ਕਈ ਵਾਰ ਵਰਤ ਕੇ ਵੇਖਿਆ ਹੈ